ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਦਾ ਮੀਡੀਆ ਲੈਂਡਸਕੇਪ ਹੈ ਉਹ ਭਾਰਤ ਦੇ ਦੂਜੇ ਰਾਜਾਂ ਨਾਲੋਂ ਬਹੁਤ ਵੱਖਰਾ ਹੈ ਅਤੇ ਉਹਨਾਂ ਨਾਲ ਬਹੁਤ ਤੁਲਨਾ ਵੀ ਰੱਖਦਾ ਹੈ ਫ਼ਰਕ ਹੈ ਅਤੇ ਪਹਿਲਾ ਜਿਹੜਾ ਫ਼ਰਕ ਉਹਨਾਂ ਦੇ ਵਿੱਚ ਹੁੰਦਾ ਹੈ ਹੁੰਦਾ ਇਕ ਭਾਸ਼ਾ ਦਾ ਜਿਹੜਾ ਪੰਜਾਬੀ ਭਾਸ਼ਾ ਵਿੱਚ ਜਿਹੜੇ ਮੀਡੀਆ ਹੈ ਉਹ ਬਹੁਤ ਜ਼ਿਆਦਾ ਪੰਜਾਬੀ ਭਾਸ਼ਾ ਵਿੱਚ ਹੀ ਬੋਲਿਆ ਜਾਂਦਾ ਹੈ ਮੀਡੀਆ ਪੰਜਾਬ ਵਿੱਚ ਅਤੇ ਜਦਕਿ ਜਿਹੜੇ ਭਾਰਤ ਦੇ ਦੂਜੇ ਦੇਸ਼ ਹਨ ਭਾਰਤ ਰਾ ਦੂਜੇ ਰਾਜ ਹਨ ਉਹਨਾਂ ਵਿੱਚ ਹਿੰਦੀ ਜਾਂ ਅੰਗਰੇਜ਼ੀ ਜ਼ਿਆਦਾ ਚੱਲਦੀ ਹੈ ਪੰਜਾਬੀ ਮੂਲ ਦੇ ਲੋਕ ਸੱਭਿਆਚਾਰ ਧਰਮ ਅਤੇ ਸੰਗੀਤ ਦੀ ਝਲਕ ਮੀਡੀਆ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਦਕਿ ਦੂਜੇ ਰਾਜਾਂ 'ਚ ਚੀਜ਼ਾਂ ਘੱਟ ਦੇਖਣ ਨੂੰ ਮਿਲਦੀ ਹੈ ਅਤੇ ਦੂਜਾ ਟੀ ਵੀ ਅਤੇ ਨਿਊਜ਼ ਮੀਡੀਆ ਪੰਜਾਬੀ ਨਿਊਜ਼ ਚੈਨਲ ਜਿਵੇਂ ਕਿ ਪੀ ਟੀ ਸੀ ਪੰਜਾਬੀ ਡੇਲੀ ਪੋਸਟ ਨਿਊਜ਼ ਨੇ ਪੰਜਾਬ ਦੀ ਰਾਜਨੀਤੀ ਕਿਸਾਨ ਅੰਦੋਲਨ ਅਤੇ ਸਿੱਖ ਧਰਮ ਨਾਲ ਜੁੜਿਆ ਮੁੱਦਿਆਂ 'ਤੇ ਵੱਖਰਾ ਅਸਰ ਪਾਇਆ ਹੈ ਹੋਰ ਰਾਜਾਂ ਦੀ ਤੁਲਨਾ ਵਿੱਚ ਪੰਜਾਬ ਵਿੱਚ ਸਿੱਖ ਧਰਮ ਅਤੇ ਕਿਸਾਨੀ ਨਾਲ ਜੁੜੀ ਖ਼ਬਰਾਂ ਨੂੰ ਬਹੁਤ ਜ਼ਿਆਦਾ ਵਧਵਾ ਵਧਾਵਾ ਮਿਲਦਾ ਹੈ ਅਤੇ ਜਿਹੜੇ ਭਾਰਤ ਦੇ ਕਈ ਹੋਰ ਰਾਜਾਂ ਵਿੱਚ ਨੈਸ਼ਨਲ ਨਿਊਜ਼ ਚੈਨਲ ਜਿਵੇਂ ਕਿ ਐਨ ਡੀ ਟੀ ਵੀ ਜੀ ਨਿਊਜ਼ ਦਾ ਵੱਧ ਪ੍ਰਭਾਵ ਹੁੰਦਾ ਹੈ ਪਰ ਪੰਜਾਬੀ ਮੀਡੀਆ ਵਿੱਚ ਸ ਸਥਾਨਕ ਨਿਊਜ਼ ਦੀ ਜ਼ਿਆਦਾ ਰੌਲਾ ਪੈਂਦਾ ਹੈ ਅਤੇ ਦੂਜਾ ਜਿਹੜਾ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੈਟਫਾਰਮਸ ਵੀ ਉਹਦੇ ਚ ਬੋਚ ਬਹੁਤ ਹੁੰਦੇ ਹੈ ਜਿਵੇਂ ਪੰਜਾਬ ਦੇ ਨੌਜਵਾਨ ਯੂਟਿਊਬ ਇੰਸਟਾਗ੍ਰਾਮ ਸਨੈਪਚੈਟ ਟਿਕਟੋਕ 'ਤੇ ਚੌਵੀ ਘੰਟੇ ਐਕਟਿਵ ਹੁੰਦੇ ਆ ਅਤੇ ਪੰਜਾਬ ਵਿੱਚ ਫੋਕ ਅਤੇ ਹਿਪ ਹੋਪ ਮਿਊਜਿਕ ਵੀ ਵਿਸ਼ਵ ਪੱਧਰ 'ਤੇ ਯੂਟੀਊਬ ਨੂੰ ਬਹੁਤ ਜ਼ਿਆਦਾ ਯੂਟੀਊਬ 'ਤੇ ਬਹੁਤ ਜ਼ਿਆਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਭੰਗੜਾ ਗਿੱਧਾ ਪੰਜਾਬ ਦਾ ਮਸ਼ਹੂਰ ਮਸ਼ਹੂਰ ਹਨ ਅਤੇ ਕਿਸਾਨ ਅੰਦੋਲਨ ਜਬ ਸਭ ਤੋਂ ਵੱਡਾ ਅੰਦੋਲਨ ਜਿਹੜਾ ਸਾਡਾ ਪੰਜਾਬ ਵਿੱਚ ਹੋਇਆ ਸੀ ਦਿੱਲੀ ਵਿੱਚ ਜਾ ਕੇ ਹੋਇਆ ਸੀ ਦੋ ਹਜ਼ਾਰ ਵੀਹ ਇੱਕੀ ਵਿੱਚ ਜਿਹੜਾ ਕੀਤਾ ਗਿਆ ਸੀ ਅਤੇ ਕਿਸਾਨ ਜਿੱਥੇ ਬਾਰਡਰਾਂ 'ਤੇ ਇੰਨੀ ਠੰਡ ਵਿੱਚ ਤਪਦੀ ਮਤਲਬ ਜਿਹੜੀ ਠੰਡ ਕਹਿ ਲਓ ਨਾ ਜਿਹਨੂੰ ਬਹੁਤ ਜ਼ਿਆਦਾ ਵਾਲੀ ਠੰਡ ਉੱਥੇ ਬੈਠੇ ਸੀ ਅਤੇ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਸੀਗਾ ਨਾ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹਥਿਆਰ ਵਜੋਂ ਵਰਤਿਆ ਗਿਆ ਸੀ ਅਤੇ ਹੋਰ ਰਾਜਾਂ ਵਿੱਚ ਇਹ ਚੀਜ਼ ਘੱਟ ਵੇਖਣ ਨੂੰ ਮਿਲੀ ਸੀ ਤਾਂ ਸੰਗੀਤ ਅਤੇ ਮਨੋਰੰਜਨ ਪੰਜਾਬ ਮਿਊਜ਼ਿਕ ਇੰਡਸਟਰੀ ਭਾਰਤ ਦੀ ਸਭ ਤੋਂ ਵੱਡੀਅ ਵਧੀਆ ਸੰਗੀਤ ਉਦਿਆ ਉਦਯੋਗਾਂ ਵਿੱਚੋਂ ਇੱਕ ਹੈ ਪੰਜਾਬੀ ਗਾਇਕ ਜਿਵੇਂ ਕਿ ਸਿੱਧੂ ਮੂਸੇਵਾਲਾ ਕਰਨ ਔਜਲਾ ਦਿਲਜੀਤ ਦੋਸਾਂਜ ਵਗੈਰਾ ਜਿਹੜੇ ਗਾਇਕ ਹਨ ਉਹ ਗਲੋਬਲ ਪੱਧਰ 'ਤੇ ਵੀ ਬਹੁਤ ਪ੍ਰਸਿੱਧ ਹਨ ਹੋਰ ਭਾਰਤੀ ਰਾਜ ਜਿਵੇਂ ਕਿ ਉੱਤਰ ਪ੍ਰਦੇਸ਼ ਬਿਹਾਰ ਕਹਿ ਲਓ ਅਤੇ ਜਿਹੜੀ ਲੋਕ ਸੰਗੀਤ ਇੰਡਸਟਰੀ ਇੰਨੀ ਵੱਡੀ ਨਹੀਂ ਹੈ ਜਿਵੇਂ ਜਿੰਨੀ ਸਾਡੀ ਪੰਜਾਬ ਦੀ ਇੰਡਸਟਰੀ ਵੱਡੀ ਹੈ ਅਤੇ ਮੈਗਜ਼ੀਨ ਅਤੇ ਅਖ਼ਬਾਰ ਪੰਜਾਬ ਵਿੱਚ ਅਜੀਤ ਜਗਬਾਣੀ ਪੰਜਾਬੀ ਟ੍ਰਿਬਿਊਨ ਪੰਜਾਬ ਕੇਸਰੀ ਜਿਹੜੇ ਵਰਗੇ ਅਖ਼ਬਾਰ ਚਲਦੇ ਹਨ ਉਹ ਬਹੁਤ ਮਸ਼ਹੂਰ ਹਨ ਅਤੇ ਉਹ ਵੀ ਸਾਡਾ ਜਿਹੜਾ ਹੈ ਮੀਡੀਆ ਜਿਹੜਾ ਹੈ ਉਹ ਕਵਰ ਕਰਦੇ ਹਨ ਅਤੇ ਜਿਹੜੇ ਹੋਰ ਰਾਜ ਆ ਹਿੰਦੀ ਅਤੇ ਅੰਗਰੇਜ਼ੀ ਅਖ਼ਬਾਰ ਚਲਦੇ ਹਨ ਜਿਵੇਂ ਕਿ ਟਾਈਮਸ ਆਫ ਇੰਡੀਆ ਹੋ ਗਿਆ ਦੈਨਿਕ ਭਾਸਕਰ ਹੋ ਗਿਆ ਹਿੰਦੁਸਤਾਨ ਟਾਈਮ ਵਰਗੇ ਜਿਹੜੇ ਹੈ ਅਖ਼ਬਾਰ ਚਲਦੇ ਹਨ ਅਤੇ ਜਿਹੜੇ ਹਿੰਦੂਸ ਅ ਪੰਜਾਬ ਵਿੱਚ ਮੀਡੀਆ ਦੇ ਦਿਸ਼ਾ ਹੋਰ ਰਾਜਾਂ ਨਾਲੋਂ ਬਹੁਤ ਵੱਖਰੀ ਹੈ ਕਿਉਂਕਿ ਇਸ ਵਿੱਚ ਸਿੱਖ ਧਰਮ ਕਿਸਾਨੀ ਮਿਊਜ਼ਿਕ ਅਤੇ ਰਾਜਨੀਤੀ ਨੂੰ ਕੇਂਦਰ ਵਿੱਚ ਬਹੁਤ ਵੱਖਰੇ ਹਨ ਅਤੇ ਜਿਹੜਾ ਪੰਜਾਬ ਵਿੱਚ ਹੈ ਉਹਨਾਂ ਦੀ ਬੋਲੀ ਹੀ ਬਹੁਤ ਵੱਖਰੀ ਹੈ ਅਤੇ ਪੰਜਾਬੀ ਚੈਨਲਸ ਤਾਂ ਹੋਣਗੇ ਹੀ ਉਹ ਅਤੇ ਉਹ ਆਪਸ ਵਿੱਚ ਵੀ ਮੀਡੀਆ ਜਿਹੜਾ ਹੈ ਲੋਕਾਂ ਦੇ ਵਿੱਚ ਕੰਮ ਆਪਣਾ ਹੈ ਵੰਡਣ ਦੀ ਵਿੱਚ ਕਰਦੇ ਨੇ ਅਤੇ ਆਪਣਾ ਜਿਹੜੀ ਚੀਜ਼ਾਂ ਨੇ ਆਪਣਾ ਕੋਈ ਵੀ ਮਾਹੌਲ ਜੋ ਵੀ ਚੱਲ ਰਿਹਾ ਹੈ ਪੰਜਾਬ ਦੇ ਸ਼ਹਿਰਾਂ ਵਿੱਚ ਉਹ ਵੰਡਣਾ ਸ਼ੁਰੂ ਕਰਦੇ ਹਨ ਅਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ ਧੰਨਵਾਦ